ਹੈਲੋ ਹਾਂਜੀ ਅਨੇਜਾ ਰੈਸਟੋਰੈਂਟ ਤੋਂ ਬੋਲ ਰਹੇ ਹੋ ਅਸੀਂ ਨਾ ਕੁਛ ਖਾਣਾ ਔਡਰ ਕਰਨਾ ਸੀ ਸਾਡੇ ਘਰ ਕੁਝ ਮਹਿਮਾਨ ਆ ਰਹੇ ਨੇ ਤਾਂ ਤੁਸੀਂ ਸਾਡੇ ਪਤੇ ਦੇ ਉੱਪਰ ਕੁਛ ਖਾਣਾ ਜਿਹੜਾ ਉਹ ਭੇਜ ਸਕਦੇ ਹੋ ਤੁਹਾਡੇ ਇੱਥੇ ਖਾਸ ਕੀ ਮਿਲਦਾ ਇੱਕ ਤਾਂ ਤੁਸੀਂ ਦਾਲ ਮੱਖਣੀ ਪੈਕ ਕਰ ਦਿਉ ਫੁੱਲ ਪਨੀਰ ਇੱਕ ਗਾਜਰ ਦਾ ਹਲਵਾ ਅਤੇ ਮਸ਼ਰੂਮ ਦੀ ਦਾਲ ਚਾਰ ਚਪਾਤੀਸ ਚਾਰ ਤੁਸੀਂ ਕੁਛ ਹੋਰ ਮਤਲਬ ਜੋ ਤੁਹਾਡੀ ਫੇਮਸ ਹੋਵੇ ਉਹ ਪੈਕ ਕਰ ਦੇਣਾ ਅਤੇ ਸਾਡਾ ਐਡਰੈੱਸ ਹੈ ਅਰਬਨ ਸਟੇਟ ਦੇ ਵਿੱਚ ਫੇਸ ਥ੍ਰੀ ਹਾਊਸ ਨੰਬਰ ਥ੍ਰੀ ਫੋਰ ਸਿਕਸ ਇਸ ਪਤੇ 'ਤੇ ਤੁਸੀਂ ਜਿੰਨਾ ਜਲਦੀ ਹੋ ਸਕਦਾ ਇਹ ਖਾਣਾ ਪੈਕ ਕਰਕੇ ਭੇਜ ਦੇਣਾ ਅਤੇ ਤਾਂ ਜੋ ਅਸੀਂ ਸਾਡੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਇਹ ਖਾਣਾ ਦੇ ਸਕੀਏ ਧੰਨਵਾਦ